ਮੈਂ ਤਰਨ ਤਾਰਨ ਦਾ ਰਹਿਣ ਵਾਲਾ ਹਾਂ ਕੈਂਸਰ ਅਤੇ ਦਿਲ ਦੀ ਬਿਮਾਰੀਆਂ ਵਰਗੀ ਗੰਭੀਰ ਬਿਮਾਰੀਆਂ ਅਤੇ ਇਲਾਜ ਲਈ ਸਹੂਲਤਾਂ ਤਾਂ ਬਹੁਤ ਹੈ ਪਰ ਸਾਡੇ ਸ਼ਹਿਰ ਵਿੱਚ ਕੋਈ ਸਹੂਲਤ ਨਹੀਂ ਹੈ ਇਸ ਕਰਕੇ ਸਾਨੂੰ ਇਸ ਸਹੂਲਤ ਲਈ ਅੰਮ੍ਰਿਤਸਰ ਜਾਣਾ ਪੈਂਦਾ ਹੈ ਅਤੇ ਉੱਥੇ ਪਹੁੰਚਣ ਲੱਗਿਆ ਸਾਨੂੰ ਬਹੁਤ ਟਾਈਮ ਲੱਗਦਾ ਹੈ ਜਿਸ ਕਰਕੇ ਕਿਸੇ ਨਾ ਕਿਸੇ ਟਾਈਮ ਅਨ ਸੇਟੇਂਜਰੀ ਘਟਨਾ ਵਾਪਰ ਜਾਂਦੀ ਹੈ ਅਤੇ ਇਸ ਕਰਕੇ ਉਹ ਜਿੰਨੇ ਤੱਕ ਅਸੀਂ ਐਬੂਲੈਂਸ ਨੂੰ ਵੀ ਕੋਲ ਕਰਦੇ ਹਾਂ ਤਾਂ ਟਾਈਮ ਬੀਤ ਚੁੱਕਾ ਹੁੰਦਾ ਹੈ ਅਤੇ ਇਸ ਕਰਕੇ ਸਾਨੂੰ ਜੋ ਹੈ ਸਾਡੇ ਸ਼ਹਿਰ ਵਿੱਚ ਸਹੂਲਤਾਂ ਦਿੱਤੀਆਂ ਜਾਣ ਸ਼ਹਿ ਕੈਂਸਰ ਅਤੇ ਦਿਲ ਦੀਆਂ ਬਿਮਾਰੀਆਂ ਦੀ ਸਹੂਲਤ ਬਹੁਤ ਹੈ ਸਾਡੇ ਦੇਸ਼ ਵਿੱਚ ਬਟ ਜਿਹੜੀ ਸਾਡੇ ਇਲਾਕੇ ਵਿੱਚ ਉਹ ਬਹੁਤ ਘੱਟ ਹਨ ਅਤੇ ਜੇ ਅਸੀਂ ਅੰਮ੍ਰਿਤਸਰ ਜਾਂਦੇ ਹਾਂ ਤਾਂ ਉਹ ਵੀ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਹਨ ਅਤੇ ਇਸ ਕਰਕੇ ਸਾਡੇ ਸ਼ਹਿਰ ਵਿੱਚ ਵੀ ਇਸ ਨੂੰ ਪਹੁੰਚਣਯੋਗ ਕੀਤਾ ਜਾਵੇ ਤਾਂ ਕਿ ਸਾਡੇ ਸ਼ਹਿਰ ਦੇ ਲੋਕ ਇਸ ਨੂੰ ਜਿਹੜਾ ਵਾ ਆਪਣੀ ਲਾਈਫ ਨੂੰ ਜਿਹੜਾ ਸਿਕਿਓਰ ਕਰ ਸਕਣ